ਮੈਂ ਆਪਣੇ ਗਵਾਂਢੀ ਨੂੰ ਬਗੀਚਾ ਲਾਉਣ ਦੇ ਵਿੱਚ ਉਹਨਾਂ ਦੀ ਖੂਬ ਮਦਦ ਕੀਤੀ ਸੀ ਕਿਉਂਕਿ ਮੈਨੂੰ ਜਿਹੜਾ ਇਹ ਕੰਮ ਬੂਟੇ ਲਗਾਉਣਾ ਬਹੁਤ ਪਸੰਦ ਹੈ ਮੈਂ ਆਪਣੇ ਘਰ ਦੇ ਵਿੱਚ ਵੀ ਬਹੁਤ ਅਲੱਗ ਵੱਖ ਵੱਖ ਤਰ੍ਹਾਂ ਦੇ ਜਿਹੜੇ ਬੂਟੇ ਆ ਉਗਾਏ ਹੋਏ ਨੇ ਮੈਂ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਬਗੀਚੇ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਰੰਗ ਬਿਰੰਗੇ ਦੁਪਹਿਰ ਖਿੜੀ ਵਰਗੇ ਬੂਟੇ ਲਗਾਓ ਅਤੇ ਹੋਰ ਵੀ ਕਈ ਤਰ੍ਹਾਂ ਦੇ ਬੂਟੇ ਜਿਵੇਂ ਕਿ ਮਨੀ ਪਲਾਂਟ ਹੁੰਦਾ ਆ ਉਹ ਵੀ ਬਹੁਤ ਵਧੀਆ ਚੱਲਦਾ ਆ ਕੈਕਟਸ ਦਾ ਪਲਾਂਟ ਹੁੰਦਾ ਆ ਉਹ ਵੀ ਬਹੁਤ ਵਧੀਆ ਚੱਲਦਾ ਹੋਰ ਵੀ ਕਈ ਤਰ੍ਹਾਂ ਦੇ ਬੂਟੇ ਹੁੰਦੇ ਨੇ ਜਿਵੇਂ ਕਿ ਐਰਕਸ ਦਾ ਪੌਦਾ ਹੁੰਦਾ ਆ ਇੱਕ ਹੋਰ ਹੋਰ ਵੀ ਮੈਂ ਉਹਨਾਂ ਨੂੰ ਸੁਝਾਅ ਦਿੱਤੇ ਕਿ ਹੋਰ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਬੂਟੇ ਜਿਹੜੇ ਆ ਉਹ ਆਪਣੀ ਉਹਦੇ ਵਿੱਚ ਲਗਾਉਣ ਬਗੀਚੇ ਦੇ ਵਿੱਚ ਤਾਂ ਕਿ ਮੈਨੂੰ ਵੀ ਦੇਖ ਕੇ ਖੁਸ਼ੀ ਹੋਵੇ ਕਿ ਉਹਨਾਂ ਨੇ ਮੇਰੀ ਮਦਦ ਦੇ ਨਾਲ ਬੂਟੇ ਲਗਾਏ ਨੇ ਅਤੇ ਬਸ ਇਹ ਮੇਰਾ ਅਨੁਭਵ ਜਿਹੜਾ ਸੀ ਉਹ ਬਹੁਤ ਵਧੀਆ ਰਿਹਾ ਮੈਂ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਕਿ ਇਹਨਾਂ ਦੇ ਵਿੱਚ ਬੂਟਿਆਂ ਦੇ ਵਿੱਚ ਟਾਈਮ ਟੂ ਟਾਈਮ ਜਿਹੜੀ ਨੈਚੁਰਲ ਖਾਦ ਹੁੰਦੀ ਹੈ ਉਹ ਪਾ ਦੇਣ ਤਾਂ ਕਿ ਬੂਟੇ ਜਿਹੜੇ ਹੈ ਵਧੀਆ ਚੱਲਦੇ ਰਹਿਣ